ਮੈਂ ਅਜਿਹਾ ਕੁਝ ਨਹੀਂ ਕੀਤਾ ਜਿਸ ਲਈ ਮੈਨੂੰ ਵਿਸ਼ੇਸ਼ ਤੌਰ 'ਤੇ ਮਾਣ ਹੋਵੇ ਮੈਂ ਇੱਦਾਂ ਦੀ ਕੋਈ ਵੀ ਡਰਾਇੰਗ ਨਹੀਂ ਬਣਾਈ ਹੈ ਜਿਸ ਨੂੰ ਮੈਂ ਦਿਖਾ ਸਕਾਂ ਇਹ ਸਿਰਫ਼ ਮੇਰੇ ਇੱਕ ਵਿਹਲਾ ਟਾਈਮ ਪਾਸ ਕਰਨ ਦਾ ਇੱਕ ਜ਼ਰੀਆ ਹੈ ਮੈਂ ਇਸ ਤੋਂ ਇਹ ਇਸਨੂੰ ਕੋਈ ਦਿਖਾ ਕੇ ਕੋਈ ਫੀਡਬੈਕ ਨਹੀਂ ਲਈ ਹੈ ਨਾ ਹੀ ਮੈਂ ਇਸਨੂੰ ਕਿਸੇ ਨਾਲ ਕੋਈ ਸਾਂਝਾ ਕਰਿਆ ਹੈ ਹੁਨਰ ਹੈ ਪਰ ਮੈਂ ਇੱਦਾਂ ਦਾ ਹੁਨਰ ਨਹੀਂ ਹੈ ਕਿ ਮੈਂ ਕਿਸੇ ਨੂੰ ਦਿਖਾ ਸਕਾਂ ਇਹ ਸਿਰਫ਼ ਮੇਰਾ ਇੱਕ ਵਿਹਲਾ ਰਹਿਣ ਦਾ ਇੱਕ ਜ਼ਰੀਆ ਹੈ